ਹੈਲੋ ਤੁਸੀਂ ਪ੍ਰਭਜੋਤ ਕੌਰ ਬੋਲ ਰਹੇ ਹੋ ਮੈਨੂੰ ਨਾ ਮੇਰੇ ਇੱਕ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀ ਐਕਚੁਲੀ ਅਤੇ ਉਹ ਕਹਿ ਰਹੇ ਸੀ ਵੀ ਤੁਸੀਂ ਪੰਜਾਬ ਤੋਂ ਕਾਫੀ ਦੇਰ 'ਚ ਰਹਿੰਦੇ ਹੋ ਮਤਲਬ ਪੰਜਾਬ ਦੇ ਹੀ ਹੋ ਅਤੇ ਮੈਂ ਨਾ ਮੁੰਬਈ ਸ਼ਹਿਰ ਤੋਂ ਮਤਲਬ ਸ਼ਿਫਟ ਹੋਈ ਸੀ ਇਸ ਮੰਨਥ ਅਤੇ ਮੈਂ ਫੂਡ ਵਲੋਗਰ ਹਾਂ ਮੈਂ ਵੀਡੀਓਜ਼ ਵਗੈਰਾ ਬਣਾਉਂਦੀ ਹਾਂ ਅਪਲੋਡ ਕਰਦੀ ਹਾਂ ਯੂਟਿਊਬ 'ਤੇ ਅਤੇ ਮੇਰਾ ਨਾ ਚੈਨਲ ਹੈ ਮਨਜੋਤ ਫੂਡ ਵਲੋੋਗਿੰਗ ਮੈਨੂੰ ਨਾ ਮਤਲਬ ਪੰਜਾਬ ਬਾਰੇ ਮਤਲਬ ਇੰਨੀ ਫੂਡ ਨੌਲੇਜ ਨਹੀਂ ਹੈਗੀ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿਹੜੇ ਕਿਹੜੇ ਫੇਮਸ ਫੂਡ ਨੇ ਪੰਜਾਬ ਦੇ ਓਕੇ ਅਤੇ ਹਾਂਜੀ ਅਤੇ ਜੀ ਜੀ ਇਹਦੀ ਸ਼ੋਪਸ ਵਗੈਰਾ ਕਿਹੜੀਆਂ ਨੇ ਉਰੇ ਓਕੇ ਓਕੇ ਹੁਣ ਮੈਂ ਨਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਬਹੁਤ ਦੱਸਿਆ ਇਸ ਲਈ ਹੁਣ ਮੈਂ ਵਲੋਗ ਕੋਈ ਕਰੂੰਗੀ ਨਾ ਸ਼ੁਰੂ ਤਾਂ ਪਟਿਆਲੇ ਦੇ ਫੂਡਸ ਤੋਂ ਹੀ ਕਰੂੰਗੀ ਥੈਂਕ ਯੂ